ਮੇਰਾ ਹੁਨਰ ਤਾਂ ਵੈਸੇ ਖੇਤੀਬਾੜੀ ਦਾ ਹੀ ਹੈ ਜਿਸ ਵਿੱਚ ਮੈਂ ਖੇਤਾਂ ਵਿੱਚ ਹਲ ਚਲਾ ਸਕਦਾ ਖੇਤਾਂ ਦੀ ਵਢਾਈ ਕਰ ਸਕਦਾ ਠੀਕ ਹੈ ਖੇਤਾਂ ਨੂੰ ਪਾਣੀ ਲਗਾ ਸਕਦਾ ਕੱਖ ਵੱਢ ਸਕਣਾ ਟੋਕਾ ਆਦਿ ਕਰ ਸਕਦਾ ਹਾਂ ਔਰ ਮੈਸਾਂ ਨੂੰ ਨਵਾ ਧੋਵਾਉਣਾ ਇਹ ਹੀ ਮੇਰਾ ਦੁੱਧ ਧਾ ਧਾਰਾ ਕੱਢਣੀਆਂ ਅਤੇ ਇੱਕ ਦੁੱਧ ਪਾਉਣਾ ਔਰ ਟਰੈਕਟਰ ਗੱਡੀ ਵਗੈਰਾ ਚਲਾਉਣਾ ਹੀ ਮੇਰਾ ਹੁਨਰ ਹੈ